ਇਕ ਬਾਈਕਰ ਨੂੰ ਕੁਝ ਮੁਢਲੇ ਰੂਲ ਪਤਾ ਹੋਣੇ ਚਾਹੀਦੇ ਹਨ ਜਿਵੇਂ ਕਿ ਮੋਟਰਸਾਈਕਲ ਚਲਾਉਣ ਵੇਲੇ ਹਮੇਸ਼ਾ ਹੈਲਮਟ ਲਗਾਣਾ ਚਾਹੀਦਾ ਹੈ ਕਦੀ ਵੀ ਬਿਨਾਂ ਲਾਇਸੈਂਸ ਤੋਂ ਮੋਟਰਸਾਈਕਲ ਨਹੀਂ ਚਲਾਉਣੀ ਚਾਹੀਦੀ ਹਮੇਸ਼ਾ ਆਪਣੀ ਰਫਤਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਕਦੇ ਵੀ ਉਚਿਤ ਰਫਤਾਰ ਤੋਂ ਵੱਧ ਰਫਤਾਰ ਤੇ ਗੱਡੀ ਨਹੀਂ ਚਲਾਣੀ ਚਾਹੀਦੀ ਹੈ ਮੋਟਰਸਾਈਕਲ ਤੇ ਲੋਡ ਤੋਂ ਵੱਧ ਸਮਾਨ ਨਹੀਂ ਰੱਖਣਾ ਚਾਹੀਦਾ ਸਾਨੂੰ ਕਦੀ ਵੀ ਟ੍ਰੈਫਿਕ ਲਾਈਟ ਨਹੀਂ ਟੱਪਣੀ ਚਾਹੀਦੀ ਸਾਨੂੰ ਹੱਥਾਂ ਦੇ ਇਸ਼ਾਰਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਨਿਕਲਣ ਤੋਂ ਪਹਿਲਾਂ ਆਪਣੀ ਮੋਟਰ ਸਾਈਕਲ ਦੀ ਹਾਲਾਤ ਦਾ ਧਿਆਨ ਦੇਣਾ ਚਾਹੀਦਾ ਹੈ ਨਿਕਲਣ ਤੋਂ ਪਹਿਲਾਂ ਸਾਨੂੰ ਜਰੂਰੀ ਦਸਤਾਵੇਜ ਵੀ ਨਾਲ ਲੈ ਕੇ ਜਾਣੇ ਚਾਹੀਦੇ ਹਨ ਕੁਛ ਦਸਤਾਵੇਜ਼ ਜਿਵੇਂ ਕਿ ਲਾਇਸੈਂਸ ਇਨਸ਼ੋਰੈਂਸ ਗੱਡੀ ਦੀ ਆਰਸੀ ਪ੍ਰਦੂਸ਼ਣ ਸਰਟੀਫਿਕੇਟ ਆਦ ਵੀ ਨਾਲ ਰੱਖਣੇ ਚਾਹੀਦੇ ਹਨ ਅਤੇ ਇਹ ਦਸਤਾਵੇਸ ਹਮੇਸ਼ਾ ਬਾਈਕਰ ਕੋਲ ਹੋਣੇ ਚਾਹੀਦੇ ਹਨ